ਹਾਂ ਮੈਨੂੰ ਆਪਣੇ ਡਾਂਸਿੰਗ ਕਰਿਅਰ ਵਿੱਚ ਇੱਕ ਚੁਣੌਤੀ ਦਾ ਬਹੁਤ ਜ਼ਿਆਦਾ ਹੀ ਡੱਟ ਕੇ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਮੈਂ ਬਚਪਨ ਤੋਂ ਹੀ ਡਾਂਸ ਵਿੱਚ ਬਿਲਕੁਲ ਅੱਛੀ ਨਹੀਂ ਸੀ ਜਦੋਂ ਮੈਂ ਪੰਜਾਬੀ ਲੋਕ ਗੀਤ ਭੰਗੜੇ ਦੀ ਪ੍ਰੈਕਟਿਸ ਸ਼ੁਰੂ ਕੀਤੀ ਸੀ ਉਦੋਂ ਮੈਨੂੰ ਇੱਕ ਵੀ ਸਟੈਪ ਚੰਗੀ ਤਰ੍ਹਾਂ ਨਹੀਂ ਆਉਂਦਾ ਸੀ ਜਿਸ ਕਰਕੇ ਮੈਨੂੰ ਹਰ ਥਾਂ 'ਤੇ ਰੁਕਾਵਟ ਮਿਲੀ ਸੀ ਪਰ ਮੈਂ ਉਹਨਾਂ ਚੁਣੌਤੀਆਂ ਨੂੰ ਦਾ ਸਾਹਮਣਾ ਕਰਦੇ ਹੋਏ ਇੱਕ ਵਧੀਆ ਭੰਗੜਾ ਕਰਨਾ ਸਿੱਖਿਆ ਅਤੇ ਇਸ ਲਈ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿ ਮੈਂ ਕਦੀ ਵੀ ਆਪਣੇ ਆਪ ਨੂੰ ਹਾ ਹਾਰਿਆ ਹੋਇਆ ਨਹੀਂ ਸਮਝਿਆ ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਇਹ ਕਿਹਾ ਕਿ ਨਹੀਂ ਮੈਂ ਕਰ ਸਕਦੀ ਹਾਂ ਅਤੇ ਮੈਂ ਉਹ ਕਰੂੰਗੀ ਕਿਉਕੀ ਮੈਂ ਬਚਪਨ ਤੋਂ ਕਦੀ ਵੀ ਡਾਂਸ ਜਾਂ ਇਸ ਤੋਂ ਇਲਾਵਾ ਕਿਸੇ ਵੀ ਚੀਜ਼ ਵਿੱਚ ਇੰਨੀ ਐਕਟਿਵ ਨਹੀਂ ਸੀ ਪਰ ਜਦੋਂ ਮੈਂ ਭੰਗੜੇ ਵਿੱਚ ਐਕਟਿਵ ਹੋਈ ਤਾਂ ਮੈਨੂੰ ਪਤਾ ਲੱਗਿਆ ਕਿ ਹਾਂ ਇਹ ਚੀਜ਼ਾਂ ਮੈਂ ਵੀ ਕਰ ਸਕਦੀ ਹਾਂ ਪਰ ਮ ਪਰ ਮੈਨੂੰ ਪਹਿਲਾਂ ਬਚਪਨ ਤੋਂ ਹੀ ਇਹ ਲੱਗਦਾ ਸੀ ਕਿ ਆਹ ਚੀਜ਼ਾਂ ਮੈਂ ਕਦੀ ਨਹੀਂ ਕਰ ਪਾਵਾਂਗੀ ਇਸ ਲਈ ਇਸ ਚੀਜ਼ ਤੋਂ ਮੈਨੂੰ ਇੰਨੀ ਇਹ ਸਿੱਖਿਆ ਮਿਲੀ ਹੈ ਕਿ ਜੇਕਰ ਤੁਸੀਂ ਕੋਈ ਚੀਜ਼ ਨੂੰ ਦਿਲ ਤੋਂ ਕਰਨਾ ਚਾਹੋ ਤਾਂ ਉਹ ਚੀਜ਼ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ ਤੁਹਾਨੂੰ